ਸਤਿ ਸ਼੍ਰੀ ਅਕਾਲ ਬੇਨਤੀ ਹੈ ਕਿ ਮੈਂ ਬਾਰ੍ਹਵੀਂਂ ਜਮਾਤ ਦਾ ਵਿਦਿਆਰਥੀ ਹਾਂ ਮੇਰੀ ਅੰਤਿਮ ਪ੍ਰੀਖਿਆ ਮਾਰਚ ਵਿੱਚ ਹੋ ਜਾਵੇਗੀ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਾਂ ਮੈਂ ਚਾਹੁੰਦਾ ਹਾਂ ਕਿ ਮੈਂ ਵੱਡਾ ਹੋ ਕੇ ਕੋਈ ਚੰਗੇ ਪਦ ਦੀ ਨੌਕਰੀ ਕਰਾਂ ਮੈਂ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਸਰਕਾਰੀ ਬੈਂਕਾਂ ਦੀ ਪ੍ਰੀਖਿਆ ਵੀ ਦੇਣਾ ਚਾਹੁੰਦਾ ਹਾਂ ਆਨਲਾਈਨ ਕਲਾਸਾਂ ਵਾਸਤੇ ਮੈਨੂੰ ਆਪਣੇ ਇੱਕ ਨਿਜੀ ਲੈਪਟੋਪ ਦੀ ਵੀ ਲੋੜ ਪਵੇਗੀ ਪਰ ਅੱਜ ਕੱਲ੍ਹ ਬਾਜ਼ਾਰ ਵਿੱਚ ਵੱਖਰੀ ਵੱਖਰੀ ਕੰਪਨੀ ਦੇ ਲੈਪਟੋਪ ਆਉਂਦੇ ਹਨ ਜਿਸ ਦੇ ਬਾਰੇ ਮੈਨੂੰ ਬਿਲਕੁਲ ਗਿਆਨ ਨਹੀਂ ਹੈ ਅਤੇ ਮੇਰੇ ਕਰਦਿਆਂ ਨੂੰ ਵੀ ਇਸ ਸੰਬੰਧੀ ਕੁਝ ਨਹੀਂ ਪਤਾ ਮੈਂ ਆਪਣੇ ਪਿਤਾ ਜੀ ਤੋਂ ਲੈਪਟੋਪ ਲਈ ਪੈਸੇ ਤਾਂ ਲੈ ਲਏ ਹਨ ਪਰ ਜਾਣਕਾਰੀ ਨਾ ਹੋਣ ਕਰਕੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਨੂੰ ਡਰ ਹੈ ਕਿ ਮੈਂ ਕੋਈ ਗਲਤ ਬਰਾਂਡ ਦਾ ਲੈਪਟੋਪ ਨਾ ਖਰੀਦ ਲਵਾਂ ਜਿਸ ਕਰਕੇ ਮੇਰੇ ਪਿਤਾ ਜੀ ਦੇ ਕਮਾਏ ਹੋਏ ਪੈਸਿਆਂ ਦਾ ਨੁਕਸਾਨ ਹੋਵੇ ਮੈਂ ਪਹਿਲਾਂ ਤੋਂ ਹੀ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹਾਂ ਕਿਰਪਾ ਕਰਕੇ ਮੈਨੂੰ ਇਸ ਉਲਝਣ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਮੇਰਾ ਮਾਰਗ ਦਰਸ਼ਨ ਕਰਿਆ ਜਾਵੇ ਮੇਰਾ ਬਜਟ ਚਾਲ੍ਹੀ ਹਜ਼ਾਰ ਹੈ ਧੰਨਵਾਦ